ਦੇਖੋ ਜੀ ਮੈਂ ਹਰ ਇੱਕ ਤਰ੍ਹਾਂ ਦਾ ਪੌਦਾ ਲਾਉਣਾ ਚਾਹਾਂਗਾ ਕਿਉਂਕਿ ਮੈਨੂੰ ਪੌਦੇ ਲਗਾਉਣ ਦਾ ਬਹੁਤ ਸ਼ੌਕ ਹੈ ਮੈਂ ਹਰ ਇੱਕ ਤਰ੍ਹਾਂ ਦਾ ਪੌਦਾ ਲਾਉਣ ਨੂੰ ਤਿਆਰ ਹਾਂ ਜਿਵੇਂ ਲਗਾ ਲਓ ਮੈਂ ਫੁੱਲ ਦਾ ਵੀ ਲਗਾ ਸਕਦਾ ਹਾਂ ਫਲਾਂ ਦਾ ਵੀ ਲਗਾ ਸਕਦਾ ਹਾਂ ਅਤੇ ਸਬਜ਼ੀਆਂ ਦਾ ਵੀ ਲਗਾ ਸਕਦਾ ਹਾਂ ਗਰਮੀਆਂ ਵਿੱਚ ਬਹੁਤ ਹੀ ਸੋਹਣੇ ਸੋਹਣੇ ਫੁੱਲ ਖਿੜ੍ਹਦੇ ਹਨ ਜੋ ਕਿ ਵੇਖਣ ਵਿੱਚ ਬਹੁਤ ਹੀ ਸੋਹਣੇ ਲੱਗਦੇ ਹਨ ਅਤੇ ਹਰ ਇੱਕ ਦੇ ਮਨ ਨੂੰ ਬਹੁਤ ਚੰਗੇ ਲੱਗਦੇ ਹਨ ਤੋ ਫੁੱਲ ਵੀ ਲਾਉਣਾ ਬਹੁਤ ਵਧੀਆ ਗੱਲ ਹੈ ਹਾਂ ਫਲ ਤੁਸੀਂ ਉਸ ਪ੍ਰਕਾਰ ਦੇ ਲਗਾਓ ਜੋ ਕਿ ਤੁਹਾਡੇ ਇਲਾਕੇ ਵਿੱਚ ਲੱਗ ਸਕਣ ਅਤੇ ਸਬਜ਼ੀਆਂ ਸਬਜ਼ੀਆਂ ਦਾ ਅਤੇ ਫਲਾਂ ਦਾ ਇਹ ਫਾਇਦਾ ਹੈ ਕਿ ਅਗਰ ਤੁਸੀਂ ਆਪ ਉਗਾਉਂਦੇ ਹੋ ਅਤੇ ਤੁਸੀਂ ਖਾਦਾਂ ਸਪਰੇਆਂ ਤੋਂ ਬਚ ਸਕੋਗੇ ਅਤੇ ਵਧੀਆ ਸ਼ੁੱਧ ਸਬਜ਼ੀਆਂ ਖਾਓਗੇ ਹਰ ਇੱਕ ਨੂੰ ਆਪਣੇ ਘਰਾਂ ਵਿੱਚ ਸਬਜ਼ੀਆਂ ਫਲ ਅਤੇ ਫੁੱਲ ਜ਼ਰੂਰ ਲਾਉਣੇ ਚਾਹੀਦੇ ਹਨ ਅਤੇ ਇਹ ਸਾਡੇ ਵਾਤਾਵਰਨ ਨੂੰ ਸਾਫ ਰੱਖਦੀਆਂ ਹਨ ਧੰਨਵਾਦ